ਮੈ ਆਪਣੇ ਕਿਸੇ ਜ਼ਰੂਰੀ ਕੰਮ ਵਜੋਂ ਰੇਲਵੇ ਸਟੇਸ਼ਨ 'ਤੇ ਪਹੁੰਚਣਾ ਸੀ ਉਹ ਟਾਇਮ ਮੇਰੇ ਕੋਲ ਬਹੁਤ ਹੀ ਜ਼ਿਆਦਾ ਘੱਟ ਸੀ ਅਤੇ ਮੈਂ ਇੱਕ ਕੈਬ ਜਿਹੜੀ ਹੈ ਉਹ ਬੁੱਕ ਕਰਵਾਈ ਸੀ ਮੈਂ ਕਾਫ਼ੀ ਦੇਰ ਗੁੱਜਰਾਂ ਵਾਲੀ ਗਲੀ ਦੇ ਬਾਹਰ ਖੜੀ ਕੇ ਹੋ ਕੇ ਆਪਣੀ ਕੈਬ ਦੀ ਉਡੀਕ ਕਰਦੀ ਰਹੀ ਪਰ ਅੱਧਾ ਘੰਟਾ ਮੇਰਾ ਉਹਨਾਂ ਨੇ ਉੱਥੇ ਹੀ ਵੇਸਟ ਕਰ ਦਿੱਤਾ ਅਤੇ ਨਾ ਹੀ ਕੈਬ ਆਈ ਜਿਸ ਕਾਰਨ ਨਾ ਮੈਂ ਰੇਲਵੇ ਸਟੇਸ਼ਨ 'ਤੇ ਪਹੁੰਚ ਸਕੀ ਅਤੇ ਅੱਗੋਂ ਮੇਰੀ ਜਿਹੜੀ ਆ ਫਲਾਈਟ ਸੀਗੀ ਉਹ ਫਲਾਈਟ ਵੀ ਮੇਰੀ ਮਿਸ ਹੋ ਗਈ ਇਸ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਭਰਨਾ ਪੈ ਰਿਹਾ ਹੈ ਅਤੇ ਮੇਰਾ ਜਿਹੜਾ ਜ਼ਰੂਰੀ ਕੰਮ ਸੀ ਉਹ ਵੀ ਮੇਰਾ ਪੂਰਾ ਨਹੀਂ ਹੋਇਆ ਹੈ ਇਸ ਕਰਕੇ ਮੈਨੂੰ ਉੱਥੇ ਖੜੀ ਖੜੀ ਨੂੰ ਇੰਨਾ ਕੁ ਗੁੱਸਾ ਚੜਿਆ ਕਿ ਨਾ ਮੇਰੇ ਮੇਰਾ ਕੰਮ ਹੋ ਸਕਿਆ ਅਤੇ ਨਾ ਹੀ ਮੇਰੀ ਕੈਬ ਜਿਹੜੇ ਮੇਰੇ ਵੱਲੋਂ ਜਿਹੜੀ ਬੁੱਕ ਕਰਵਾਈ ਹੋਈ ਸੀ ਕੈਬ ਉਹ ਹੀ ਸਮੇਂ ਸਿਰ ਪੁੱਜ ਸਕੀ ਜਿਸ ਕਰਕੇ ਮੇਰਾ ਬਹੁਤ ਹੀ ਜ਼ਿਆਦਾ ਟਾਈਮ ਜਿਹੜਾ ਹੈ ਉਹ ਬਰਬਾਦ ਹੋਇਆ ਹੈ ਅਤੇ ਜਿਹੜੇ ਮੇਰੇ ਬੁਕਿੰਗ ਦੇ ਪੈਸੇ ਸੀ ਉਹ ਵੀ ਮੇਰੇ ਬਹੁਤ ਹੀ ਜ਼ਿਆਦਾ ਬਰਬਾਦ ਹੋਏ ਕਿਉਂਕਿ ਉਹ ਜਿਹੜੀ ਬੁਕਿੰਗ ਦੇ ਪੈਸੇ ਸੀਗੇ ਉਹ ਮੈਨੂੰ ਦੁਬਾਰਾ ਨਹੀਂ ਮਿਲ ਸਕਦੇ ਕਿਉਂਕਿ ਮੈਂ ਆਪਣੀ ਕੈਂਸਲ ਜਿਹੜੀ ਹੈ ਸੀਟ ਉਹ ਪਹਿਲੇ ਨਹੀਂ ਸੀ ਕਰਵਾਈ ਇਸ ਕਰਕੇ ਮੈਨੂੰ ਉਹਦਾ ਜਿਹੜਾ ਹੈ ਮਤਲਬ ਕਿ ਪੈਸੇ ਨਹੀਂ ਮਿਲੇ ਅਤੇ ਜਿਹੜੀ ਮੈਂ ਕੈਬ ਵੀ ਬੁੱਕ ਕਰਵਾਈ ਸੀ ਉਹਦੇ 'ਤੇ ਮੈਨੂੰ ਬਹੁਤ ਹੀ ਨਿਸ਼ਾ ਨਿਰਾਸ਼ਾ ਹੋਈ ਹੈ ਕਿਉਂਕਿ ਮੈਂ ਆਪਣੀ ਸਮੇਂ ਦੀ ਸਹੂਲਤ ਲੈਣ ਵਾਸਤੇ ਹੀ ਕੈਬ ਬੁੱਕ ਕਰਵਾਈ ਸੀ ਜਦੋਂ ਮੈਨੂੰ ਕੈਬ ਦੀ ਸਹੂਲਤ ਹੀ ਨਹੀਂ ਮਿਲੀ ਅਤੇ ਅੱਗੇ ਮੈਂ ਰੇਲਵੇ ਸਟੇਸ਼ਨ 'ਤੇ ਵੀ ਨਾ ਪੁੱਜ ਸਕੀ ਅਤੇ ਮੈਂ ਆਪਣੇ ਜਿਹੜੇ ਆ ਅੱਗੇ ਆਪਣੇ ਕਿਸੇ ਕੰਮ 'ਤੇ ਵੀ ਜਿਹੜਾ ਹੈ ਨੋ ਉਹ ਨਹੀਂ ਪੁਜ ਸਕੀ ਜਿਹੜਾ ਮੇਰਾ ਕੰਮ ਜ਼ਰੂਰੀ ਸੀ ਉਹ ਵੀ ਮੇਰਾ ਡਿਲੇਅ ਹੋ ਗਿਆ ਜਿਸ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੋਈ ਹੈ ਮੈਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਕਰਕੇ ਮੈਂ ਮੈਂ ਉਹਨਾਂ ਨੂੰ ਕਹਾਂਗੀ ਕਿ ਮੈਂ ਜਿਹੜਾ ਰਿਫੰਡ ਹੈ ਉਹ ਮੇਰਾ ਦੁਬਾਰਾ ਦਿੱਤਾ ਜਾਵੇ ਤਾਂ ਕਿ ਮੈਂ ਅਗ ਆਪਣਾ ਅਗਲਾ ਜਿਹੜਾ ਵੀ ਆ ਵਿਊ ਪੁਆਇੰਟ ਕਰ ਸਕਾਂ ਇਸ ਕਰਕੇ ਇਹਨਾਂ ਦੇ ਰਿਫੰਡ ਮੇਰਾ ਵਾਪਸ ਕਰ ਸਕਣ